ਮੇਰੇ ਹਰ ਸਮੇਂ ਦੀ ਮਨਪਸੰਦ ਪਕ ਪਕਵਾਨ ਕਚੋਰੀਆਂ ਹਨ ਜੋ ਕਿ ਮੈਂ ਦਹੀਂ ਨਾਲ਼ ਬੜੇ ਚਾਅ ਨਾਲ ਖਾਂਦੀ ਹਾਂ ਅਤੇ ਉਹ ਮੇਰੇ ਗਰਮੀ ਸਰਦੀਆਂ ਹਰ ਸਮੇਂ ਦੀ ਮਨਪਸੰਦ ਹਨ ਉਹ ਉਸ ਵਿੱਚ ਆਲੂ ਭਰੇ ਹੁੰਦੇ ਹਨ ਇਸ ਕਰਕੇ ਮੈਨੂੰ ਉਹ ਬਹੁਤ ਪਸੰਦ ਹਨ ਅਤੇ ਉਸ ਵਿੱਚ ਉਹ ਬਹੁਤ ਕੁਰਕਰੀਆਂ ਹੁੰਦੀਆਂ ਹਨ ਇਸ ਲਈ ਮੈਨੂੰ ਉਹ ਹਰ ਸਮੇਂ ਦੀ ਮਨਪਸੰਦ ਹਨ